ਸਾਡੇ ਖੇਤਰ ਵਿੱਚ ਜਿਹੜੇ ਡਾਕਟਰਾਂ ਅਤੇ ਨਰਸਾਂ ਸੀ ਸਿਹਤ ਵਿਭਾਗ ਦੇ ਵਿੱਚ ਪੇਸ਼ੇਵਰ ਜਿਹੜੀਆਂ ਚੁਣੌਤੀਆਂ ਆਉਂਦੀਆਂ ਉਹ ਇਹ ਆਉਂਦੀਆਂ ਜਦੋਂ ਕੋਈ ਬੰਦਾ ਪੜ੍ਹ ਲਿਖ ਕੇ ਡਾਕਟਰ ਬਣ ਗਿਆ ਜਾਂ ਨਰਸ ਬਣ ਗਈ ਕੋਈ ਤਾਂ ਉਹਨੂੰ ਚੁਣੌਤੀਆਂ ਇਹ ਆਉਂਦੀਆਂ ਵੀ ਉਹ ਜਿਹੜਾ ਪੜ੍ਹ ਲਿਖ ਕੇ ਹੁੰਦਾ ਵੀ ਉਹ ਉੰਨਾ ਆਪਣਾ ਉਹਦੇ 'ਤੇ ਵੀ ਆਪਣੇ ਪੇਸ਼ੈਂਟ ਆ ਅਤੇ ਵੀ ਜਿਹੜੇ ਉਹਨਾਂ ਦੇ ਮਰੀਜ਼ ਹੁੰਦੇ ਆ ਉੰਨੀ ਮਿਹਨਤ ਲਗਾਉਣੀ ਉਹਨਾਂ 'ਤੇ ਛੱਡ ਦਿੰਦੇ ਆ ਕਿਉਂਕਿ ਜਿਹੜੇ ਡਾਕਟਰ ਹੁੰਦੇ ਆ ਉਹਨਾਂ ਨੂੰ ਤਾਂ ਇਹ ਹੁੰਦਾ ਕਿ ਵੀ ਅਸੀਂ ਮਰੀਜ਼ 'ਤੇ ਟਾਈਮ ਨਹੀਂ ਲਗਾਉਣਾ ਕਿਉਂਕਿ ਸਾਡੀ ਤਨਖਾਹ ਤਾਂ ਚੜੇ ਮਹੀਨੇ ਆ ਹੀ ਜਾਣੀ ਆ ਸਗੋਂ ਉਹਦੀ ਨਰਸਾਂ ਥੋੜ੍ਹਾ ਬਹੁਤਾ ਯੋਗਦਾਨ ਦੇ ਦਿੰਦੀਆਂ ਪਰ ਬਹੁਤ ਘੱਟ ਦਿੰਦੀਆਂ ਨੇ ਇਸ ਤੋਂ ਇਲਾਵਾ ਜਿਵੇਂ ਕਿ ਸਿੱਖਿਆਂ ਦੇ ਖੇਤਰ ਵਿੱਚ ਪੂੰਜੀ ਸਰੋਤਾਂ ਦੇ ਬੁਨਿਆਦੀ ਢਾਂਚੇ ਦੀ ਘਾਟ ਅਤੇ ਉਹਨਾਂ ਦੇ ਇਲਾਜ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਕਰਦੀ ਆ ਇਹਦੇ ਵਿੱਚ ਇਹ ਆ ਕਿ ਜਿਹੜੇ ਸਿੱਖਿਆ ਦੇ ਖੇਤਰ ਵਿੱਚ ਆ ਵੀ ਜਿਹੜੇ ਗਰੀਬ ਲੋਕ ਹੁੰਦੇ ਆ ਉਹਨਾਂ ਨੂੰ ਨਾ ਤਾਂ ਕੋਈ ਚੰਗੀ ਸਿੱਖਿਆ ਹੁੰਦੀ ਨਾ ਹੀ ਉਹਨਾਂ ਕੋਲ ਕੋਈ ਪੂੰਜੀ ਹੁੰਦੀ ਆ ਮਤਲਬ ਕਿ ਉਹਨਾਂ ਕੋਲ ਕੋਈ ਪੈਸਾ ਹੁੰਦਾ ਅਤੇ ਜਿਹੜੇ ਸਰੋਤ ਹੁੰਦੇ ਆ ਨਾ ਹੀ ਉਹਨਾਂ ਕੋਲ ਕੋਈ ਹੋਰ ਸ੍ਰੋਤ ਪਿਆ ਹੁੰਦਾ ਜਿਹਦੇ ਨਾਲ ਉਹਨਾਂ ਨੂੰ ਇਲਾਜ ਕਰਵਾਉਣ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਜਿਹੜੇ ਡਾਕਟਰ ਨੇ ਜਾਂ ਨਰਸਾਂ ਨੇ ਉਹ ਜਿਹੜੇ ਗਰੀਬ ਲੋਕ ਇਲਾਜ ਕਰਵਾਉਣ ਜਾਂਦੇ ਨੇ ਉਹਨਾਂ ਨੂੰ ਪ੍ਰਾਈਵੇਟ ਹੋਸਪਿਟਲ ਰੈਕਮੈਂਡਡ ਕਰਦੇ ਨੇ ਵੀ ਉੱਥੇ ਜਾਣ ਦੇ ਹਵਾਲੇ ਦਿੰਦੇ ਨੇ ਇਹ ਹਵਾਲੇ ਵੀ ਜਿਹੜੇ ਡਾਕਟਰ ਨੇ ਉਹਨਾਂ ਦੀ ਪੂੰਜੀ ਦੇ ਨਾਲ ਹੀ ਜੁੜੇ ਹੁੰਦੇ ਆ ਪੂੰਜੀ ਦੇ ਨਾਲ ਇਸ ਕਰਕੇ ਜੁੜੇ ਹੁੰਦੇ ਆ ਕਿਉਂਕਿ ਜਿਹੜਾ ਉਹ ਕੋਈ ਪ੍ਰਾਈਵੇਟ ਹੋਸਪਿਟਲ ਦਾ ਉੱਥੇ ਗਰੀਬ ਬੰਦੇ ਨੂੰ ਜਾਣ ਲਈ ਕਹੂਗਾ ਉਹ ਉਹਨਾਂ ਨਾਲ ਕੋਈ ਨਾ ਕੋਈ ਕੰਟੈਕਟ ਹੋਊਗਾ ਉਹਨਾਂ ਦਾ ਜਿਵੇਂ ਕਹਿ ਦਿੰਦੇ ਤੁਸੀਂ ਆਹ ਹੋਸਪਿਟਲ ਚੋਂ ਅਲਟ੍ਰਾਸਾਊਂਡ ਕਰਵਾ ਲਿਓ ਆਹ ਹੋਸਪਿਟਲ ਚੋਂ ਟੈਸਟ ਕਰਵਾ ਲਿਓ ਜਾਂ ਆਹ ਹੋਸਪਿਟਲ ਚੋਂ ਆਪਰੇਸ਼ਨ ਕਰਵਾਓ ਡਾਕਟਰਾਂ ਦਾ ਕਈ ਵਾਰ ਤਾਂ ਉਹ ਆ ਆਨਰ ਹੀ ਉਹ ਆਪ ਹੁੰਦਾ ਪ੍ਰਾਈਵੇਟ ਹੋਸਪਿਟਲ ਦਾ ਅਤੇ ਇਹ ਜਿਹੜਾ ਪ੍ਰਾਈਵੇਟ ਹੋਸਪਿਟਲ ਵਾਲਾ ਸੰਬੰਧ ਹੈ ਇਹ ਵੀ ਵੀ ਲੋਕਾਂ ਨੂੰ ਲੁੱਟਣ ਲਈ ਹੁੰਦਾ ਅਤੇ ਜਿਹੜੇ ਡਾਕਟਰ ਨਰਸਾਂ ਨੇ ਵੀ ਬਹੁਤ ਜ਼ਿਆਦਾ ਲੋਕਾਂ ਨਾਲ ਉਹ ਅੱਤਿਆਚਾਰ ਕਰਦੇ ਹੈ ਵੀ ਐਵੇਂ ਵੀ ਘਪਲਾ ਕਰਦੇ ਆ